ਪਰੰਪਰਾਗਤ ਮੌਕਿਆਂ 'ਤੇ ਸਮੇਂ ਜਿਹੜੇ ਉਹਨਾਂ ਦੇ ਪਹਿਰਾਵੇ ਹੁੰਦੇ ਨੇ ਉਹ ਆਮ ਨਹੀਂ ਹੁੰਦੇ ਉਹ ਖਾਸ ਹੁੰਦੇ ਨੇ ਅਲੱਗ ਹੁੰਦੇ ਨੇ ਚਮਕਦਾਰ ਕੱਪੜੇ ਪਾ ਰੱਖੇ ਹੁੰਦੇ ਨੇ ਤਿਆਰ ਹੋ ਰੱਖੇ ਹੁੰਦੇ ਨੇ ਮਤਲਬ ਵੱਖਰੇ ਹੁੰਦੇ ਨੇ ਜਿਹੜੇ ਆਮ ਨਿੱਜੀ ਜ਼ਿੰਦਗੀ 'ਚ ਕੱਪੜੇ ਪਾਏ ਜਾਂਦੇ ਹਨ ਪਹਿਰਾਵਾ ਹੁੰਦਾ ਉਹ ਨਹੀਂ ਹੁੰਦਾ ਅਤੇ ਜਿਹੜਾ ਉਂ ਰਵਾਇਤੀ ਪੰਜਾਬੀ ਕੱਪੜੇ ਹਨ ਉਨ੍ਹਾਂ 'ਚ ਮੁੰਡਿਆਂ ਦੇ ਕੁੜਤਾ ਚਾਦਰਾ ਹੁੰਦਾ ਅਤੇ ਪੱਗ ਹੁੰਦੀ ਆ ਪੰਜਾਬੀ ਜੁੱਤੀ ਪਾਉਂਦੇ ਨੇ ਉਹ ਅਤੇ ਗਹਿਣਿਆਂ ਦੇ ਵਿੱਚ ਜੋ ਉਹ ਕੈਂਠਾ ਪਾਉਂਦੇ ਨੇ ਅਤੇ ਸਾਮਾਂ ਦੀ ਡਾਂਗ ਫੜੀ ਹੁੰਦੀ ਉਨ੍ਹਾਂ ਦੇ ਮੁੰਡਿਆਂ ਨੇ ਅਤੇ ਜੇ ਔਰਤਾਂ ਦੇ ਪੱਖ ਦੀ ਗੱਲ ਕਰੀਏ ਤਾਂ ਔਰਤਾਂ ਸਲਵਾਰ ਸੂਟ ਪਾਉਂਦੀਆਂ ਨੇ ਸਿਰ 'ਤੇ ਚੁੰਨੀ ਹੁੰਦੀ ਉਨ੍ਹਾਂ ਦੇ ਸੱਗੀ ਫੁੱਲ ਲੱਗੇ ਹੁੰਦੇ ਨੇ ਗੁੱਤੀਆ 'ਚ ਗੁੱਤ 'ਚ ਪਰਾਂਦੀ ਪਾ ਰੱਖੀ ਹੁੰਦੀ ਆ ਪੈਰਾਂ 'ਚ ਘੁੰਗਰੂ ਪਾਇਲਾਂ ਪਾਈਆਂ ਹੁੰਦੀਆ ਨੇ ਉਨ੍ਹਾਂ ਨੇ ਝਾਂਜਰਾਂ ਪਾਈਆਂ ਹੁੰਦੀਆ ਨੇ ਛਾਂਪਾਂ ਛੱਲੇ ਪਾ ਕੇ ਰੱਖਦੀਆਂ ਨੇ ਮਤਲਬ ਇਸ ਤਰ੍ਹਾਂ ਦਾ ਪਹਿਰਾਵਾ ਹੁੰਦਾ ਅਤੇ ਬਹੁਤ ਸੁੰਦਰ ਲੱਗਦੇ ਨੇ ਉਹ ਨੱਚਣ ਅਤੇ ਪੰਜਾਬੀ ਲੋਕ ਨਾਚ ਮੁੰਡਿਆਂ ਦਾ ਜਿਹੜਾ ਉਹ ਭੰਗੜਾ ਅਤੇ ਜਿਹੜਾ ਕੁੜੀਆਂ ਦਾ ਲੋਕ ਨਾਚ ਆ ਉਹ ਗਿੱਧਾ ਅਤੇ ਉਹ ਇਹ ਪਹਿਰਾਵੇ 'ਚ ਬਹੁਤ ਬਹੁਤ ਸੋਹਣੇ ਲੱਗਦੇ ਨੇ ਬਹੁਤ ਚੰਗੇ ਲੱਗਦੇ ਨੇ